ਸਪਰੇਹਾਂ ਦੀ ਕੀਮਤ ਵੀ ਵੱਧ ਗਈ ਹੈ ਹੁਣ ਮਜ਼ਦੂਰਾਂ ਦੀ ਮਜ਼ਦੂਰੀ ਵੀ ਵੱਧ ਗਈ ਹੈ ਅਤੇ ਨਾਲ ਨਾਲ ਤੇਲ ਦੇ ਖਰਚੇ ਵਧ ਗਏ ਹਨ ਜਿਸ ਦੇ ਕਰਕੇ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਪਰ ਜਿਹੜਾ ਖਰਚਾ ਪੈ ਜਾਂਦਾ ਹੈ ਜਦੋਂ ਕਿਸਾਨਾਂ ਦੇ ਉੱਪਰ ਖਰਚਾ ਹੁੰਦਾ ਹੈ ਤਾਂ ਉਹ ਚੀਜ਼ ਆਟੋਮੈਟਿਕਲੀ ਦੁਕਾਨਾਂ ਦੇ ਵਿੱਚ ਆਉਣ ਦੇ ਨਾਲ ਵਧ ਜਾਂਦੀ ਹੈ ਅਤੇ ਮੈਂ ਸਬਜ਼ੀਆਂ ਕਈ ਵਾਰ ਜਿੱਦਾਂ ਔਨਲਾਈਨ ਸ਼ੋਪਿੰਗ ਦੇ ਵਿੱਚ ਆਪਾਂ ਦੇਖਦੇ ਹਾਂ ਸਬਜ਼ੀਆਂ ਜਿਹੜੀਆਂ ਹੁੰਦੀਆਂ ਨੇ ਮਤਲਬ ਮੈਂ ਦੋਨੇ ਸ਼ੋਪਿੰਗ ਕਰ ਲੈਂਦੀ ਹਾਂ ਕਈ ਵਾਰ ਅਕੋਰਡਿੰਗ ਟੂ ਕਿ ਮੈਂ ਕਿਸ ਤਰ੍ਹਾਂ ਤਰੀਕੇ ਦਾ ਮੈਂ ਪ੍ਰੋਡਕਟ ਲੈਣਾ ਹੈ ਕਿਉਂਕਿ ਮੈਂ ਹੁਣ ਇਸ ਟਾਈਮ ਵਰਕਿੰਗ ਦੇ ਵਿੱਚ ਹਾਂ ਜਿਹੜੇ ਇਹਦੇ ਨਾਲ ਕੀ ਹੁੰਦਾ ਜਦੋਂ ਮੈਂ ਔਨਲਾਈਨ ਸ਼ੋਪਿੰਗ ਕਰਦੀ ਹਾਂ ਤਾਂ ਜਿਹੜੇ ਮੇਰੇ ਟਾਈਮ ਦੀ ਆ ਉਹ ਬੱਚਤ ਹੋ ਜਾਂਦੀ ਹੈ ਅਤੇ ਮੈਨੂੰ ਜਿਹੜਾ ਪ੍ਰੋਡਕਟ ਚਾਹੀਦਾ ਹੁੰਦਾ ਉਹ ਮੈਂ ਔਡਰ ਕਰ ਦਿੰਦੀ ਹਾਂ ਤਾਂ ਕਿ ਮੇਰਾ ਜਿਹੜਾ ਟਾਈਮ ਬਾਜ਼ਾਰਾਂ ਦੇ ਵਿੱਚ ਖਰਾਬ ਨਹੀਂ ਹੁੰਦਾ ਬਟ ਜਿਵੇਂ ਕਿ ਮੈਂ ਦਾਲਾਂ ਜਾਂ ਸਬਜ਼ੀਆਂ ਦੀ ਗੱਲ ਕਰਦੀ ਹਾਂ ਤਾਂ ਮੈਂ ਇਹ ਚੀਜ਼ ਔਫ ਮਤ ਜਾ ਕੇ ਕਰਿਆਨਾ ਸਟੋਰ ਜਾਂ ਮੌਲ ਜਾਂ ਮੰਡੀ 'ਚ ਜਾ ਕੇ ਹੀ ਲੈਣਾ ਪਸੰਦ ਕਰਦੀ ਹਾਂ ਕਿਉਂਕਿ ਇਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਮੈਨੂੰ ਪ੍ਰੋਡਕਟ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਕਿੱਦਾਂ ਦਾ ਪ੍ਰੋਡਕਟ ਆ ਉਹਦੀ ਕੁਆਲਿਟੀ ਦਾ ਪਤਾ ਲੱਗ ਜਾਂਦਾ ਹੈ ਉਹਦੀ ਕੁਆਂਟੀਟੀ ਦਾ ਵੀ ਪਤਾ ਲੱਗ ਜਾਂਦਾ ਹੈ ਅਤੇ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਬਾਰਗੇਨਿੰਗ ਹੈ ਉਹ ਵੀ ਅੱਛੀ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਆ ਕੁੱਲ ਮਿਲਾ ਕੇ ਔਨਲਾਈਨ ਸ਼ਾਪਿੰਗ ਦੇ ਫਾਇਦੇ ਵੀ ਹਨ ਅਤੇ ਆਪਾਂ ਨੂੰ ਨੁਕਸਾਨ ਵੀ ਹਨ